ਮੰਮੀ ਮੈਨੂੰ ਆਪਣੇ ਬਜਟ ਦੀ ਬਹੁਤ ਚਿੰਤਾ ਹੈਗੀ ਹੈ ਇਸ ਮਹੀਨੇ ਤਾਂ ਮੇਰਾ ਬਜਟ ਹਿੱਲ ਹੀ ਚੁੱਕਿਆ ਹੈ ਇਹ ਚੀਜ਼ ਮੇਰੇ ਨਾਲ ਪਿਛਲੇ ਬਹੁਤ ਸਾਰੇ ਟਾਈਮ ਤੋਂ ਹੋਈ ਜਾਂਦੀ ਹੈ ਜਿਸ ਕਾਰਨ ਮੈਂ ਤਾਂ ਸੋਚੀ ਜਾਂਦੀ ਹਾਂ ਜਿਵੇਂ ਮੈਂ ਆਪਣੇ ਫੋਨ ਦਾ ਹੀ ਯਾਨੀ ਮੋਬਾਈਲ ਯੋਜਨਾ ਨੂੰ ਘਟਾ ਕਰ ਲਾਂ ਇਸ ਦੇ ਨਾਲ ਮੇਰੀ ਕਾਫ਼ੀ ਬੱਚਤ ਹੋ ਜਾਵੇਗੀ ਕਿਉਂਕਿ ਮੇਰੇ ਓਫਿਸ ਵਿੱਚ ਤਾਂ ਫ੍ਰੀ ਨੈਟ ਮਿਲਦਾ ਹੀ ਹੈ ਮੈਂ ਫੋਨ ਵਿੱਚ ਨੈੱਟ ਲੈ ਕੇ ਜ਼ਿਆਦਾ ਦੇਰ ਕੀ ਕਰਨਾ ਹੈ ਮੈਂ ਤਾਂ ਮਹੀਨੇ ਸਾਲ ਦੇ ਇਕੱਠਾ ਰੀਚਾਰਜ ਕਰਵਾਉਣ ਦੀ ਬਜਾਏ ਦਿਨ ਦੇ ਹਿਸਾਬ 'ਤੇ ਕਰਵਾ ਲੈਂਦੀ ਹਾਂ ਨਾਲੇ ਇਸ ਦੇ ਨਾਲ ਮੇਰਾ ਖਰਚਾ ਵੀ ਘਟਾ ਘੱਟ ਹੋ ਜਾਵੇਗਾ ਅਤੇ ਮੇਰਾ ਬਜਟ ਵੀ ਘੱਟ ਹਿੱਲੇਗਾ ਤੁਸੀਂ ਵੀ ਮੈਨੂੰ ਇਹ ਹੀ ਰਾਏ ਦਿੰਦੇ ਹੋ ਮੈਂ ਵੀ ਇਹ ਹੀ ਸੋਚੀ ਜਾਂਦੀ ਹਾਂ ਜਿਵੇਂ ਮੈਂ ਕਰ ਹੀ ਲਾਂ ਜਿਆਦਾ ਫੋਨ ਕੋਲ 'ਤੇ ਉੱਤੇ ਲਗਾਉਣ ਦੇ ਬਜਾਏ ਉਹ ਪੈਸੇ ਬਚਾ ਕੇ ਮੈਂ ਸੇਵਿੰਗ ਕਰ ਲਾਂਗੀ ਹੋਰ ਵੀ ਬਹੁਤ ਥਾਵਾਂ 'ਤੇ ਹੋ ਸਕਦਾ ਹੈ ਪਰ ਇਹ ਮੈਨੂੰ ਜ਼ਿਆਦਾ ਜ਼ਰੂਰੀ ਲੱਗਦਾ ਹੈ